ਸਾਡੇ ਇੱਥੇ ਹੋਸਪਿਟਲਾਂ ਦਾ ਪ੍ਰਬੰਧ ਬਹੁਤ ਵਧੀਆ ਹੈ ਸਰਕਾਰੀ ਹੋਸਪਿਟਲ 'ਚ ਥੋੜ੍ਹੀ ਸਫਾਈ ਘੱਟ ਹੁੰਦੀ ਹੈ ਪਰ ਉੱਥੇ ਡਾਕਟਰ ਵੈਸੇ ਵਧੀਆ ਹੁੰਦੇ ਨੇ ਇ ਇਸ ਤੋਂ ਇਲਾਵਾ ਜਿਹੜੇ ਪ੍ਰਾਈਵੇਟ ਹੋਸਪਿਟਲ ਹੈ ਉਹਨਾਂ ਵਿੱਚ ਸਾਨੂੰ ਟਾਈਮ ਘੱਟ ਲੱਗਦਾ ਹੈ ਸਾਫ ਸਫਾਈ ਬਹੁਤ ਜ਼ਿਆਦਾ ਹੁੰਦੀ ਹੈ ਸਟਾਫ ਬਹੁਤ ਅੱਛਾ ਹੁੰਦਾ ਟਾਈਮ ਘੱਟ ਲੱਗਦਾ ਸਾਨੂੰ ਇਲਾਜ ਵੀ ਵਧੀਆ ਮਿਲ ਜਾਂਦਾ ਹੈ ਪਰ ਉਹਦੇ 'ਚ ਐਂ ਆ ਕਿ ਪੈਸੇ ਜ਼ਿਆਦਾ ਲੱਗ ਜਾਂਦੇ ਹੈ ਔਰ ਸਰਕਾਰੀ ਹੋਸਪਿਟਲ 'ਚ ਜੇ ਲਾਈਨਾਂ ਬਹੁਤ ਲੰਬੀਆਂ ਲੱਗੀਆਂ ਵੀਆਂ ਇਲਾਜ ਉੱਥੇ ਵੀ ਬਹੁਤ ਵਧੀਆ ਹੁੰਦਾ ਹੈ ਪਰ ਉਹਦੇ 'ਚ ਐਂ ਏ ਕਿ ਸਾਨੂੰ ਥੋੜ੍ਹਾ ਜਿਹਾ ਅ ਪੈਸਿਆਂ ਦਾ ਥੋੜ੍ਹਾ ਜਿਹਾ ਫਾਇਦਾ ਹੋ ਜਾਂਦਾ ਹੈ ਡਾਕਟਰ ਉੱਥੇ ਵੀ ਬਹੁਤ ਵਧੀਆ ਹੁੰਦੇ ਨੇ ਇਹੋ ਜਿਹੀ ਕੋਈ ਗੱਲ ਨਹੀਂ ਹੈਗੀ ਇਲਾਜ ਉੱਥੇ ਵੀ ਬਹੁਤ ਵਧੀਆ ਹੁੰਦਾ ਬਾਕੀ ਸਾਰੀਆਂ ਸਹੂਲਤਾਂ ਠੀਕ ਹੋਗੀਆਂ ਹੋਸਪਿਟਲ 'ਚ ਸਰਕਾਰੀ ਹੋਸਪਿਟਲ 'ਚ ਥੋੜ੍ਹਾ ਜਿਹਾ ਇੱਕ ਘੱਟ ਮਿਲਦੀਆਂ ਸਹੂਲਤਾਂ ਪ੍ਰਾਈਵੇਟ ਹੋਸਪਿਟਲ 'ਚ ਥੋੜ੍ਹੀ ਜਿਹੀ ਜ਼ਿਆਦਾ ਮਿਲ ਜਾਂਦੀਆਂ ਪਰ ਅ ਇਲਾਜ ਦੋਨੇਂ ਜਗ੍ਹਾ ਬਹੁਤ ਵਧੀਆ ਹੁੰਦਾ